ਵਿਗਿਆਨ ਅਤੇ ਟੈਕਨੋਲੋਜੀ ਪਹਿਲਾਂ ਵਿਗਿਆਨ ਸਾਡਾ ਸਾਡੇ ਦੇਸ਼ ਵਿੱਚ ਬਹੁਤ ਘੱਟ ਸੀ ਪਰ ਹੁਣ ਸਾਡੇ ਦੇਸ਼ ਵਿੱਚ ਵਿਗਿਆਨ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਜਿਸ ਕਾਰਨ ਸਾਡਾ ਦੇਸ਼ ਬਹੁਤ ਜ਼ਿਆਦਾ ਤਰੱਕੀ ਕਰ ਰਿਹਾ ਨਵੀਆਂ ਨਵੀਆਂ ਖੋਜਾਂ ਕਰ ਰਿਹਾ ਵਿਗਿਆਨ ਜੋ ਕਿ ਬਹੁਤ ਜ਼ਿਆਦਾ ਮਹੱਤਵਪੂਰਨ ਹੋ ਚੁੱਕਿਆ ਹੈ ਅੱਜ ਦੇ ਜ਼ਮਾਨੇ ਵਿੱਚ ਦੇਸ਼ ਨੂੰ ਅੱਗੇ ਵਧਾਉਣ ਲਈ ਵਿਗਿਆਨ ਬਹੁਤ ਜ਼ਰੂਰੀ ਹੈ ਵਿਗਿਆਨ ਜਿਵੇਂ ਅੱਜ ਆਪਾਂ ਦੇਖਦੇ ਹਾਂ ਕਿ ਵਿਗਿਆਨ ਦਿਨੋਂ ਦਿਨ ਤਰੱਕੀ ਕਰ ਰਿਹਾ ਹੈ ਜਿਸ ਨਾਲ ਆਪਾਂ ਵਿਗਿਆਨ ਦੇ ਰਾਹੀਂ ਆਪਾਂ ਜਿਵੇਂ ਕਿ ਆਪਾਂ ਆਪਣੇ ਖੇਤਾਂ ਵਿੱਚ ਪਹਿਲਾਂ ਸਾਰਾ ਕੰਮ ਆਪਾਂ ਜੇ ਆਪਾਂ ਕੋਈ ਵੀ ਜ਼ਮੀਨ ਨੂੰ ਫਸਲ ਨੂੰ ਵਾਹੁਣਾ ਹੁੰਦਾ ਸੀ ਤਾਂ ਉਦੋਂ ਆਪਾਂ ਸਿਰਫ ਬਲਦਾਂ ਦੀ ਅਤੇ ਬੰਦਿਆਂ ਦੀ ਹੀ ਸਹਾਇਤਾ ਨਾਲ ਆਪਾਂ ਕੰਮ ਕਰ ਸਕਦੇ ਸੀ ਪਰ ਅੱਜ ਦੇ ਵਿਗਿਆਨ ਨੇ ਐਨੀ ਜ਼ਿਆਦਾ ਤਰੱਕੀ ਕਰ ਲਈ ਹੈ ਕਿ ਹੁਣ ਆਪਾਂ ਜ਼ਮੀਨ ਜ਼ਮੀਨ ਨੂੰ ਆਪਾਂ ਫਸਲਾਂ ਨੂੰ ਉਗਾਉਣ ਲਈ ਹੁਣ ਆਪਾਂ ਮਸ਼ੀਨਾਂ ਦਾ ਉਪਯੋਗ ਕਰ ਰਹੇ ਹਾਂ ਜੋ ਕਿ ਵਿਗਿਆਨ ਦਾ ਬਹੁਤ ਵਜ ਵੱਡੀ ਤਰੱਕੀ ਹੈ ਹੁਣ ਆਪਾਂ ਇਹਨਾਂ ਮਸ਼ੀਨਾਂ ਰਾਹੀਂ ਆਪਣੇ ਖੇਤ ਦੀ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੀ ਮਾਪ ਸਕਦੇ ਹਾਂ ਅਤੇ ਉਹਨਾਂ ਨੂੰ ਕਿੰਨਾ ਆਪਣੀਆਂ ਫਸਲਾਂ ਨੂੰ ਪਾਣੀ ਚਾਹੀਦਾ ਉਹ ਵੀ ਸਾਨੂੰ ਪਤਾ ਲੱਗਦਾ ਹੈ ਅਤੇ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਸਾਡੀਆਂ ਫਸਲਾਂ ਨੂੰ ਕਿੰਨਾ ਕੁ ਖਾਦ ਦੀ ਜ਼ਰੂਰਤ ਹੈ ਕਿੰਨੀਆਂ ਕਿੰਨੀਆਂ ਸਪਰੇਹਾਂ ਦੀ ਜ਼ਰੂਰਤ ਹੈ ਜਿਸ ਨਾਲ ਆਪਾਂ ਫਸਲਾਂ ਦੀ ਉਪਜਾਊ ਸ਼ਕਤੀ ਨੂੰ ਵੀ ਵਧਾ ਸਕਦੇ ਹਾਂ ਜੋ ਕਿ ਆ ਸਾਡੇ ਲਈ ਬਹੁਤ ਜ਼ਰੂਰੀ ਹੈ ਵਿਗਿਆਨ ਸਾਨੂੰ ਹਰੇਕ ਜਗ੍ਹਾ ਤੋਂ ਬਹੁਤ ਜ਼ਿਆਦਾ ਸਹਾਇਤਾ ਕਰਦਾ ਹੈ ਵਿਗਿਆਨ ਨਾਲ ਹਰੇਕ ਕੰਮ ਬਹੁਤ ਹੀ ਜਲਦੀ ਅਤੇ ਬਹੁਤ ਜਲਦੀ ਪੂਰਾ ਹੋ ਜਾਂਦਾ ਜਿਸ ਨਾਲ ਸਮਾਂ ਤਾਂ ਬਹੁਤ ਬਚਦਾ ਅਤੇ ਕਈ ਵਾਰ ਸਾਨੂੰ ਬਹੁਤ ਚੀਜ਼ਾਂ ਦਾ ਪਤਾ ਲੱਗ ਜਾਂਦਾ ਹੈ ਅਤੇ ਟੈਕਨੋਲੋਜੀ ਟੈਕਨੋਲੋਜੀ ਨੇ ਹੁਣ ਦੇਸ਼ ਵਿੱਚ ਇੰਨੀ ਜ਼ਿਆਦਾ ਤਰੱਕੀ ਕਰ ਲਈ ਹੈ ਜਿੱਥੇ ਪਹਿਲਾਂ ਇੱਕ ਦੂਜੇ ਨੂੰ ਚਿੱਠੀਆਂ ਰਾਹੀਂ ਆਪਾਂ ਸੰਦੇਸ਼ ਪਹੁੰਚਾਉਂਦੇ ਸੀ ਜਿਸ ਨੂੰ ਚਾਰ ਪੰਜ ਦਿਨ ਲੱਗ ਜਾਂਦੇ ਸੀ ਇੱਕ ਜਗ੍ਹਾ ਤੋਂ ਦੂਸਰੀ ਤਰ੍ਹਾਂ ਜਗ੍ਹਾ ਤੱਕ ਸੰਦੇਸ਼ ਪਹੁੰਚਾਉਣ ਲਈ ਪਰ ਹੁਣ ਜਦੋਂ ਤੱਕ ਜਦੋਂ ਦੀ ਦੋ ਹਜ਼ਾਰ ਅੱਠ ਤੋਂ ਬਾਅਦ ਇੰਟਰਨੈਟ ਦੀ ਖੋਜ ਹੋਈ ਹੈ ਜਾਂ ਉਸ ਤੋਂ ਪਹਿਲਾਂ ਫੋਨਾਂ ਦੀ ਖੋਜ ਰ ਹੋਈ ਹੈ ਇਸ ਨਾਲ ਸਾਡੇ ਅਸੀਂ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਬੈਠੇ ਬੰਦੇ ਨਾਲ ਕਿਸੇ ਵੀ ਟਾਈਮ ਸੰਪਰਕ ਕਰ ਸਕਦੇ ਹਾਂ ਜੋ ਕਿ ਬਹੁਤ ਵੱਡੀ ਟੈਕਨੋਲਜੀ ਆਪਣੇ ਦੇਸ਼ ਆਪਣੇ ਦੁਨੀਆ ਨੇ ਪ੍ਰਾਪਤ ਕੀਤੀ ਹੈ ਫੋਨ ਬਹੁਤ ਜ਼ਿਆਦਾ ਸਹਾਈ ਹੈ ਜਿਸ ਨਾਲ ਅਸੀਂ ਸਾਰਾ ਸਮਾਨ ਹੁਣ ਤਾਂ ਆਪਾਂ ਔਨਲਾਈਨ ਵੀ ਆਰਡਰ ਕਰ ਸਕਦੇ ਹਾਂ ਜੋ ਕਿ ਬਹੁਤ ਜ਼ਿਆਦਾ ਮਹੱਤਵਪੂਰਨ ਵੀ ਹੈ ਅਤੇ ਜਿਸ ਨਾਲ ਬਹੁਤ ਜ਼ਿਆਦਾ ਟਾਈਮ ਅਤੇ ਪੈਸਾ ਬਚਦਾ ਹੈ